ਡਿਜ਼ੀਟਲ ਪੇਂਟਿੰਗ ਜੋ ਹੈ ਅੱਜ ਕੱਲ੍ਹ ਦੇ ਦੌਰ ਵਿੱਚ ਕਾਫੀ ਪ੍ਰਸਿੱਧ ਹੋ ਰਹੀ ਹੈ ਜਿਵੇਂ ਕਿ ਆਈਪੈਡਸ ਦੇ ਉੱਤੇ ਡਿਜ਼ੀਟਲ ਪੇਂਟਿੰਗ ਕੀਤੀ ਜਾਂਦੀ ਹੈ ਪੈੱਨ ਨਾਲ ਅਤੇ ਐਂਡਰੋਇਡ ਲਈ ਵੀ ਬਹੁਤ ਸਾਰੀਆਂ ਐਪਸ ਨੇ ਬਟ ਜੋ ਟਰਡੀਸ਼ਨਲ ਪੇਂਟਿੰਗ ਹੈ ਉਸਨੂੰ ਕਰਨ ਦਾ ਆਪਣਾ ਹੀ ਇੱਕ ਮਜ਼ਾ ਹੈ ਡਿਜ਼ੀਟਲ ਪੇਂਟਿੰਗ ਦੇ ਵਿੱਚ ਅਸੀਂ ਸਕਰੀਨ ਦੇ ਉੱਤੇ ਹੀ ਕਲਰ ਸਿਲੈਕਟ ਕਰਕੇ ਉਹਨੂੰ ਫਿਲ ਕਰਨਾ ਪਰ ਟਰਡੀਸ਼ਨਲ ਪੇਂਟਿੰਗ ਦੇ ਵਿੱਚ ਅਸੀਂ ਅਲੱਗ ਅਲੱਗ ਕਲਰਸ ਨੂੰ ਮਿਕਸ ਕਰਕੇ ਇੱਕ ਨਵਾਂ ਕਲਰ ਬਣਾਉਂਦੇ ਹਾਂ ਅਤੇ ਸ਼ੀਟ ਦੇ ਉੱਤੇ ਉਸਨੂੰ ਜਦੋਂ ਕਰਦੇ ਹਾਂ ਉਸ ਤੋਂ ਬਾਅਦ ਉਸ ਨੂੰ ਫਰੇਮ ਕਰਾ ਕੇ ਕਿਤੇ ਡਿਸਪਲੇਅ ਦੇ ਵਿੱਚ ਲਗਾਉਂਦੇ ਹਾਂ ਉਸ ਨਾਲ ਬਹੁਤ ਫਰਕ ਪੈਂਦਾ ਹੈ ਡਿਜ਼ੀਟਲ ਪੇਂਟਿੰਗ ਵੀ ਆਪਣੀ ਜਗ੍ਹਾ ਬਹੁਤ ਵਧੀਆ ਹੈ ਬਟ ਮੈਨੂੰ ਡਿਜ਼ੀਟਲ ਪੇਂਟਿੰਗ ਦੀ ਜਗ੍ਹਾ ਟਰਡੀਸ਼ਨਲ ਪੇਂਟਿੰਗ ਦਾ ਸਟਾਈਲ ਹੀ ਜ਼ਿਆਦਾ ਪਸੰਦ ਹੈ ਡਿਜ਼ੀਟਲ ਪੇਂਟਿੰਗ ਦੇ ਵਿੱਚ ਸਕਰੀਨ ਟਾਈਮ ਵੀ ਬਹੁਤ ਵੱਧਦਾ ਹੈ ਜਿਸ ਨਾਲ ਅੱਖਾਂ ਦੇ ਉੱਤੇ ਜੋ ਹੈ ਉਹ ਗਲਤ ਪ੍ਰਭਾਵ ਪੈਂਦਾ ਹੈ ਅਤੇ ਟਰਡੀਸ਼ਨਲ ਪੇਂਟਿੰਗ ਕਰਨ ਦੇ ਵਿੱਚ ਤੁਸੀਂ ਜੋ ਹੈ ਉਹ ਅੱਖਾਂ ਦੇ ਉੱਤੇ ਨੈਗਟਿਵ ਜੋ ਯੂ ਵੀ ਰੇਜ਼ ਨੇ ਸਕਰੀਨ ਦੀਆਂ ਉਹ ਨਹੀਂ ਪਾਉਂਦੇ ਹੋ ਇਸ ਕਰਕੇ ਮੈਂ ਟਰਡੀਸ਼ਨਲ ਪੇਂਟਿੰਗ ਕਰਨਾ ਜ਼ਿਆਦਾ ਪਸੰਦ ਕਰਦੀ ਹਾਂ